ਭਾਰਤ ਇਕ ਬਹੁਤ ਵੱਡਾ ਦੇਸ਼ ਹੈ ਇੱਥੇ ਅੱਜ ਦੇ ਸਮੇਂ ਵਿੱਚ ਹਰ ਪ੍ਰਕਾਰ ਦੇ ਉਦਯੋਗ ਦੇ ਵਿਕਾਸ ਦੇ ਕਾਰਜ ਹੋ ਰਹੇ ਹਨ ਚਾਹੇ ਉਹ ਉਦਯੋਗਿਕ ਖੇਤਰ ਵਿੱਚ ਹੋਵੇ ਜਾਂ ਸਿਹਤ ਸੇਵਾਵਾਂ ਅਤੇ ਸੜਕਾਂ ਦੇ ਵਿਕਾਸ ਅਤੇ ਟੈਕਨੋਲਜੀ ਪੱਧਰ ਉੱਤੇ ਹੋਵੇ ਭਾਰਤ ਦੀ ਅਰਥ ਵਿਵਸਥਾ ਹਰ ਖੇਤਰ ਵੱਧ ਰਹੀ ਹੈ ਅਤੇ ਮਜ਼ਬੂਤ ਹੋ ਰਹੀ ਹੈ ਅੱਜ ਕੱਲ੍ਹ ਸਮੇਂ ਦੀ ਬੱਚਤ ਕਰਨ ਲਈ ਬਹੁਤ ਲੋਕ ਇੰਟਰਨੈਟ ਦੀ ਜ਼ਿਆਦਾ ਵਰਤੋਂ ਕਰਦੇ ਹਨ ਚਾਹੇ ਉਹ ਕਿੰਨੀ ਵੀ ਕਿਸੇ ਵੀ ਖੇਤਰ ਵਿੱਚ ਹੋਵੇ ਇਸ ਦਾ ਆਪਣਾ ਬਹੁਤ ਮਹੱਤਵ ਹੈ ਭਾਰਤੀਯ ਅਸਥ ਵਿਵਸਥਾ ਨੂੰ ਮਜ਼ਬੂਤ ਅਤੇ ਉੱਚੇ ਚੁੱਕਣ ਵਿੱਚ ਕਿਉਂਕਿ ਭੁਗਤਾਨ ਨੂੰ ਅੱਜ ਕੋਲ ਅੱਜ ਕੱਲ੍ਹ ਡਿਜੀਟਲ ਤਰੀਕੇ ਨਾਲ ਕਰਨਾ ਲੋਕ ਜ਼ਿਆਦਾ ਪਸੰਦ ਕਰਦੇ ਹਨ